ਹੈਲੋ ਜੀ ਮੈਂ ਨਾ ਮਨਜੋਤ ਕੌਰ ਬੋਲ ਰਹੀ ਹਾਂ ਵੀ ਮੈਂ ਤੁਹਾਡੇ ਤੋਂ ਨਾ ਸੂਟ ਸਿਲਾਉਂਦੀ ਹਾਂ ਪਟਿਆਲਾ ਟੇਲਰ ਸ਼ੋਪ ਤੋਂ ਤੁਸੀਂ ਉੱਥੋਂ ਹੀ ਬੋਲ ਰਹੇ ਹੋ ਮੈਂ ਨਾ ਇੱਕ ਸ਼ਰਟ ਸਿਲਵਾਈ ਸੀ ਸਿਲਵਾਈ ਸੀ ਤੁਹਾਡੇ ਤੋਂ ਬਲੈਕ ਕਲਰ ਦੀ ਉਹ ਮੈਨੂੰ ਨਾ ਫਿਟਿੰਗ ਥੋੜ੍ਹੀ ਜਿਹੀ ਸਹੀ ਨਹੀਂ ਆਈ ਬਾਜੂ ਤੋਂ ਟਾਈਟ ਆ

ਜੀ ਹੋਰ ਕੱਫ ਵੀ ਉਹਦੇ ਸਹੀ ਨਹੀਂ ਆ ਰਹੇ ਹਾਂਜੀ ਤੁਹਾਡੀ ਓ ਕੰਪਨੀ ਇਹ ਤਾਂ ਬਟ ਮੈਨੂੰ ਕੱਲ੍ਹ ਪਾਉਣੀ ਸੀ ਮੈਨੂੰ ਚਾਹੀਦੀ ਸੀਗੀ ਮੈਨੂੰ ਟਾਈਮਿੰਗ ਦੇ ਦਿਓ ਫਿਰ ਮੈਂ ਆ ਜਾਂਗੀ ਤੁਹਾਡੇ ਕੋਲ ਇਹਦੀ ਕੋਈ ਐਕਸਟ੍ਰਾ ਕੋਸਟ ਤਾਂ ਨਹੀਂ ਹੋਏਗੀ ਉਹ ਤਾਂ ਕੋਈ ਗੱਲ ਨਹੀਂ ਬਸ ਤੁਸੀਂ ਮੈਨੂੰ ਟਾਈਮਿੰਗ ਦੇ ਦਿਓ